ਭਾਰਤੀ ਸਮਾਜ ਵਿੱਚ ਧਰਮ ਦੀ ਬਹੁਤ ਵੱਡੀ ਭੂਮਿਕਾ ਹੈ ਭਾਰਤ ਦੀ ਜ਼ਿਆਦਾਤਰ ਗਿਣਤੀ ਕਹਿ ਲਈਏ ਤਾਂ ਉਹ ਧਾਰਮਿਕ ਵਿਚਾਰਾਂ ਤੋਂ ਪ੍ਰਭਾਵਿਤ ਹੈ ਕਿਸੇ ਨਾ ਕਿਸੇ ਧਰਮ ਨੂੰ ਮੰਨਦੀ ਹੈ ਅਨੇਕਾਂ ਹੀ ਧਰਮ ਹਨ ਭਾਰਤ ਦੇ ਵਿੱਚ ਲੋਕ ਅਲੱਗ ਅਲੱਗ ਧਰਮਾਂ ਨੂੰ ਮੰਨਦੇ ਹਨ ਕੋਈ ਹਿੰਦੂ ਧਰਮ ਨੂੰ ਮੰਨਦਾ ਹੈ ਕੋਈ ਮੁਸਲਮਾਨ ਧਰਮ ਨੂੰ ਸਿੱਖ ਧਰਮ ਨੂੰ ਈਸਾਈ ਧਰਮ ਜੈਨ ਧਰਮ ਬੋਧ ਧਰਮ ਅਤੇ ਸਾਰੇ ਧਰਮਾਂ ਦੇ ਮੂਲ ਵਿੱਚ ਇੱਕ ਚੀਜ਼ ਸਾਂਝੀ ਹੈ ਉਹ ਇਹ ਹੈ ਕਿ ਸਾਰੇ ਉਪਦੇਸ਼ ਦਿੰਦੇ ਨੇ ਬਈ ਆਪਾਂ ਸਾਰੇ ਇੱਕ ਹਾਂ ਕਿ ਜੋ ਵੀ ਮਨੁੱਖ ਨੇ ਉਹ ਸਾਰੇ ਇੱਕ ਤੋਂ ਪੈਦਾ ਹੋਏ ਹਨ ਅਤੇ ਕੋਈ ਭੇਦਭਾਵ ਨਹੀਂ ਹੈਗਾ ਪਰ ਕੁਝ ਰੀਤੀਆਂ ਧਾਰਮਿਕ ਜਾਂ ਕਹਿ ਲਉ ਕਿ ਉਹਦੇ ਵਿੱਚ ਜੋ ਕੱਟੜਤਾ ਆ ਗਈ ਜਾਂ ਕਰਮਕਾਂਡ ਆ ਗਏ ਉਹ ਅਲੱਗ ਹੋਣ ਕਰਕੇ ਜਿਹੜੀ ਧਰਮ ਦੇ ਉੱਪਰੋਂ ਦਿਖ ਹੈ ਹਰ ਇੱਕ ਦੀ ਉਹ ਅਲੱਗ ਅਲੱਗ ਹੋ ਗਈ ਜਿਸ ਕਰਕੇ ਜੋ ਜ਼ਿਆਦਾ ਇਨ੍ਹਾਂ ਕਰਮਕਾਂਡਾਂ ਵਿੱਚ ਜੁੜੇ ਹੁੰਦੇ ਹਨ ਉਹ ਧਰਮਾਂ ਨੂੰ ਅਲੱਗ ਸਮਝਦੇ ਨੇ ਪਰ ਜੇ ਆਪਾਂ ਦੇਖਿਆ ਜਾਵੇ ਮੂਲ ਤਾਂ ਸਾਰੇ ਧਰਮ ਇੱਕੋ ਨੇ ਉਹ ਇੱਕ ਦਾ ਉਪਦੇਸ਼ ਦਿੰਦੇ ਨੇ ਉਹ ਮਿਲ ਜੁਲ ਕੇ ਰਹਿਣ ਲਈ ਕਹਿੰਦੇ ਨੇ ਉਹ ਦਇਆ ਨਿਮਰਤਾ ਨੂੰ ਮੰਨਦੇ ਨੇ ਅਤੇ ਇੱਕ ਦੂਜੇ ਦੀ ਮਦਦ ਕਰਨ ਨੂੰ ਕਹਿੰਦੇ ਨੇ ਅਤੇ ਇਸ ਕਰਕੇ ਇੱਕ ਨਾਗਰਿਕ ਵਜੋਂ ਸਾਨੂੰ ਸਾਰਿਆਂ ਨੂੰ ਬਰਾਬਰ ਮੰਨਣਾ ਚਾਹੀਦਾ ਹੈ ਅਤੇ ਧਰਮ ਕੋਈ ਵੱਖਰਾ ਨਹੀਂ ਹੈਗਾ ਕੋਈ ਅਲੱਗ ਅਲੱਗ ਨਹੀਂ ਕਰਦਾ ਅਤੇ ਸਾਰਿਆਂ ਨੂੰ ਇੱਕ ਰਹਿਣ ਦਾ ਸੰਦੇਸ਼ ਦਿੰਦਾ ਹੈ